ਹਾਂਜੀ ਸਤਿ ਸ਼੍ਰੀ ਅਕਾਲ ਜੀ ਮੋਬਾਇਲ ਦੇ ਟੀ ਵੀ ਦੇ ਬਹੁਤ ਹੀ ਜ਼ਿਆਦਾ ਨੁਕਸਾ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੈ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਨਿਗਾਹ ਅੱਜ ਕੱਲ੍ਹ ਦੇ ਨਿਆਣੇ ਜ਼ਿਆਦਾਤਰ ਖੇਡਾਂ ਨਾਲੋਂ ਮੋਬਾਈਲ ਅਤੇ ਟੀ ਵੀ ਨੂੰ ਦੇਖਣਾ ਪਸੰਦ ਕਰਦੇ ਹਨ ਜਿਹਦੇ ਨਾਲ ਇਹਨਾਂ ਦੀ ਨਿਗਾਹ 'ਤੇ ਅਸਰ ਪੈਂਦਾ ਹੈ ਅਤੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਬਿਮਾਰੀਆਂ ਲੱਗਦੀਆਂ ਹਨ ਕਿਉਂਕਿ ਇਹ ਇੱਕ ਜਗ੍ਹਾ 'ਤੇ ਬੈਠ ਕੇ ਇਹ ਦੇਖਦੇ ਹਨ